ਹਾਂਜੀ ਹਾਂਜੀ ਹਾਂਜੀ ਕਿਵੇਂ ਹੋ ਤੁਸੀਂ ਮੈਂ ਵੀ ਵਧੀਆ ਹਾਂ ਹਾਂ ਮੈਂ ਤਾਂ ਸੋਚ ਮੈਂ ਤਾਂ ਸੋਚਦੀ ਸੀ ਮੈਂ ਰਿਆਤ ਕੋਲਜ ਵਿੱਚ ਮਤਲਬ ਉਹ ਲਵਾਂ ਐਡਮਿਸ਼ਨ ਖਰੜ ਹਾਂਜੀ ਹਾਂਜੀ ਨਹੀਂ ਨਹੀਂ ਹੋਰ ਤਾਂ ਮੈਂ ਹਲੇ ਪਤਾ ਕੀਤਾ ਨਹੀਂ ਹੈ ਕਿਉਂਕਿ ਮੇਰੇ ਫਰੈਂਡ ਉੱਥੇ ਲੱਗ ਰਹੇ ਆ ਨਾ ਤਾਂ ਕਰਕੇ ਹਾਂਜੀ ਹਾਂ ਹਾਂ ਉਹ ਤਾਂ ਹੈਗਾ ਏ ਮਤਲਬ ਜਿੱਦਾਂ ਸਕੋਲਰਸ਼ਿਪ ਦਾ ਤਾਂ ਜਿੱਦਾਂ ਜਿਹੜੇ ਮਤਲਬ ਐਸ ਸੀ ਆ ਨਾ ਮਤਲਬ ਜਿਹੜੇ ਐਸ ਸੀ ਆ ਮਤਲਬ ਉਹਨਾਂ ਦੀ ਤਾਂ ਫੀਸ ਮਾਫ ਆ ਨਾ ਫੀਸ ਵਗੈਰਾ ਆ ਜਾਂਦੀ ਆ ਸਕੋਲਰਸ਼ਿਪ ਆ ਜਾਂਦੀ ਆ ਅਤੇ ਆਪਾਂ ਉਹਤੇ ਸਟੱਡੀ ਮਤਲਬ ਵਧੀਆ ਤਰੀਕੇ ਨਾਲ ਕਰ ਸਕਦੇ ਖਰੜ 'ਚ ਮਤਲਬ ਖਰੜ ਮੈਨੂੰ ਬੈਸਟ ਲੱਗਿਆ ਕੋਲੇਜ ਬਾਕੀ ਹੋਰ ਵੀ ਹੈਗੇ ਆ ਹਾਂ ਇਹ ਵੀ ਆ ਦੇਖ ਲਓ ਕਿੱਥੇ ਲੱਗਣਾ ਵੈਸੇ ਹਾਂ ਹਾਂ ਇਹ ਵੀ ਠੀਕ ਆ ਮੈਂ ਤਾਂ ਬਸ ਮੈਂ ਤਾਂ ਪਲਸ ਟੂ ਤੋਂ ਬਾਅਦ ਸੀ ਐਸ ਸੀ ਵਾਈ ਕਰਨਾ ਆ ਅੱਗੇ ਕੋ ਕੋਲੇਜ ਹਾਂਜੀ ਠੀਕ ਏ ਬਸ ਵੀ ਖਰੜ ਕੋਲੇਜ ਵੀ ਵਧੀਆ ਆ ਮੈਨੂੰ ਤਾਂ ਉਹੀ ਵਧੀਆ ਲੱਗਿਆ ਜੇ ਤੁਸੀਂ ਉੱਥੇ ਇਹ ਉੱਥੇ ਲੱਗਣਾ ਤਾਂ ਉੱਥੇ ਦੇਖ ਲਾ ਠੀਕ ਏ ਓਕੇ